ਹੈਲੋ ਸਰ ਤੁਸੀਂ ਫਾਈਵ ਸਟਾਰ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਅਸੀਂ ਤੁਹਾਡੇ ਤੋਂ ਨਾ ਥਾਲ਼ੀ ਔਡਰ ਕੀਤੀ ਸੀਗੀ ਸਪੈਸ਼ਲ ਥਾਲ਼ੀ ਅਸੀਂ ਉਹਦੇ ਵਿੱਚ ਨਾ ਸਵੀਟ ਡਿਸ਼ ਐਡ ਕਰਵਾਉਣਾ ਚਾਹੁੰਦੇ ਹਾਂ ਜਿਵੇਂ ਕਿ ਆਈਸ ਕ੍ਰੀਮ ਵਗੈਰਾ ਆਈਸ ਕ੍ਰੀਮ ਦੇ ਫਲੇਵਰ ਸਰ ਤੁਸੀਂ ਚੋਕਲੇਟ ਫਲੇਵਰ ਕਰ ਦਿਓ ਬਟਰਸਕੋਚ ਡਾਇਲਾ ਔਰ ਸਰ ਕੇਕ ਦੇ ਵੀ ਇੱਕ ਤਾਂ ਚੋਕਲੇਟ ਹੋ ਗਿਆ ਅਤੇ ਦੂਸਰਾ ਫਰੂਟ ਕੇਕ ਹੋ ਗਿਆ ਹਲਵਾ ਸੂਜੀ ਦਾ ਔਰ ਆਟੇ ਦਾ ਹੋਰ ਸਰ ਮਤਲਬ ਜਿਸ ਤਰ੍ਹਾਂ ਸਵੀਟ ਡਿਸ਼ ਹੋ ਗਈਆਂ ਬਰਫ਼ੀ ਹੋ ਗਈ ਨਾਰੀਅਲ ਦੀ ਬਰਫ਼ੀ ਹੋ ਗਈ ਪਤੀਸਾ ਬਰਫ਼ੀ ਹੋ ਗਈ ਮਿਲਕ ਕੇਕ ਹੋ ਗਿਆ ਹੋਰ ਸਰ ਗੁਲਾਬ ਜਾਮਨ ਰਸਗੁੱਲਾ